ਹੈਲੋ ਸਰ ਤੁਸੀਂ ਮੀਸ਼ੋ ਤੋਂ ਬੋਲਦੇ ਸਰ ਮੈਂ ਤੁਹਾਡੇ ਕੋਲੋਂ ਨਾ ਦੋ ਪ੍ਰੋਡਕਟ ਖਰੀਦੇ ਪਹਿਲਾ ਪ੍ਰੋਡਕਟ ਮੈਂ ਆਪਣੇ ਬੇਟੇ ਲਈ ਸੂਟ ਖਰੀਦਿਆ ਜੋ ਕਿ ਬਹੁਤ ਜ਼ਿਆਦਾ ਵਧੀਆ ਨਿਕਲਿਆ ਉਸ ਤੋਂ ਖੁਸ਼ ਹੋ ਕੇ ਮੈਂ ਆਪਣੇ ਲਈ ਇੱਕ ਕਾਲੇ ਰੰਗ ਦੀ ਜੈਕਟ ਮੰਗਵਾਈ ਸੀ ਜਿਸ ਤੋਂ ਮੈਨੂੰ ਬਹੁਤ ਸਾਰੀਆਂ ਸ਼ਿਕਾਇਤਾਂ ਨੇ ਪਹਿਲੀ ਸ਼ਿਕਾਇਤ ਸਰ ਜੈਕਟ ਉਹ ਮੇਰੇ ਨਾਪ ਦੀ ਨਹੀਂ ਆ ਮੈਨੂੰ ਬਹੁਤ ਜ਼ਿਆਦਾ ਖੁੱਲ੍ਹੀ ਆ ਜੋ ਕਿ ਮੈਨੂੰ ਨਹੀਂ ਆਉਂਦੀ ਸੀ ਦੂਸਰੀ ਉਹਦੇ ਸਾਰੇ ਬਟਨ ਢਿੱਲੇ ਆ ਅਤੇ ਤੀਸਰੀ ਸ਼ਿਕਾਇਤ ਆ ਕਿ ਉਸਦਾ ਜਿਹੜੀ ਜੇਬ ਵੀ ਇੱਕ ਆ ਜੋ ਕਿ ਬਹੁਤ ਛੋਟੀ ਹੈ ਉਸਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਚੀਜ਼ ਨਹੀਂ ਆਉਂਦੀ ਚੌਥਾ ਉਹਨੂੰ ਇੱਕ ਵਾਰੀ ਧੋਣ ਦੇ ਨਾਲ ਉਸਦਾ ਸਾਰਾ ਰੰਗ ਲੱਥ ਗਿਆ ਸੋ ਸਰ ਮੈਂ ਤੁਹਾਡੇ ਇਸ ਪ੍ਰੋਜੈਕਟ ਤੋਂ ਬਹੁਤ ਜ਼ਿਆਦਾ ਨਾਖੁਸ਼ ਹਾਂ ਅਤੇ ਬਹੁਤ ਜ਼ਿਆਦਾ ਦੁਖੀ ਵੀ ਹਾਂ ਕਿਉਂਕਿ ਮੇਰੇ ਪੈਸੇ ਵੀ ਬਰਬਾਦ ਹੋ ਗਏ ਅਤੇ ਸਰ ਬੇਨਤੀ ਆ ਕਿ ਤੁਸੀਂ ਆਪਣੇ ਕਸਟਮਰਾਂ ਨੂੰ ਖੁਸ਼ ਰੱਖਣ ਲਈ ਤੁਹਾਡੇ ਕੋਲ ਕਸਟਮਰ ਜਿਸ ਤਰ੍ਹਾਂ ਦੀ ਚੀਜ਼ ਮੰਗਵਾਉਂਦਾ ਤੁਸੀਂ ਉਹਨੂੰ ਉਸੇ ਤਰ੍ਹਾਂ ਦੀ ਸੇਲ ਕਰਿਆ ਕਰੋ ਆਪਣੇ ਕਸਟਮਰਾਂ ਨੂੰ ਨਰਾਜ਼ ਨਾ ਕਰੋ ਤਾਂ ਜੋ ਤੁਸੀਂ ਕਸਟਮਰਾਂ ਨੂੰ ਨਰਾਜ਼ ਨਾ ਕਰੋ ਇਸ ਨਾਲ ਤੁਹਾਡਾ ਹੀ ਨੁਕਸਾਨ ਹੋਏਗਾ ਅਤੇ ਰਿਕੁਐਸਟ ਆ ਕਿ ਤੁਸੀਂ ਆਪਣੇ ਕਸਟਮਰਾਂ ਨੂੰ ਵਧੀਆ ਤੋਂ ਵਧੀਆ ਚੀਜ਼ ਭੇਜੋ ਤਾਂ ਕਿ ਤੁਹਾਡਾ ਕਸਟਮਰ ਖੁਸ਼ ਰਹਿ ਸਕਣ ਅਤੇ ਤੁਸੀਂ ਵੀ ਖੁਸ਼ ਰਹਿ ਸਕੋ ਧੰਨਵਾਦ ਸਰ ਥੈਂਕ ਯੂ